ਹੈਲੋ ਸਤਿ ਸ਼੍ਰੀ ਅਕਾਲ ਮੈਂ ਪਿੰਕੀ ਬੋਲਦੀ ਪਈ ਹਾਂ ਇਸਲਾਮਾਬਾਦ ਮੁਹੱਲੇ ਤੋਂ ਗੁਰਦਾਸਪੁਰ ਤੋਂ ਅਤੇ ਮੈਂ ਮੈਂ ਆਪਣੇ ਤੰਦਰੁਸਤੀ ਬਾਰੇ ਦੱਸਦੀ ਪਈ ਹਾਂ ਕਿ ਮੇਰੇ ਮੈਨੂੰ ਸਰਵਾਈਕਲ ਦੀ ਦਰਦ ਆ ਇੱਕ ਮੇਰੇ ਪੇਨ ਦਰਦ ਪੇਨ ਹੁੰਦੀ ਆ ਲੱਕ 'ਚ ਪੇਨ ਹੁੰਦੀ ਹੈ ਸਰਵਾਈਕਲ ਦੀ ਦਰਦ ਆ ਬਹੁਤ ਜ਼ਿਆਦਾ ਅਤੇ ਮੈਂ ਮਤਲਬ ਕਿ ਮੇਰੇ ਪ੍ਰੇਸ਼ਨ ਹੋਏਗਾ ਅਤੇ ਪ੍ਰੇਸ਼ਨ ਵਿੱਚ ਪ੍ਰੇਸ਼ਨ ਅਤੇ ਮੇਰੇ ਟਾਂਕਿਆਂ 'ਤੇ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਅਤੇ ਮੈਂ ਮਤਲਬ ਕਿ ਸਾਲ ਪੰਜਾਹ ਕੁ ਸਾਲ ਵਿੱਚ ਇੱਕ ਵਾਰ ਮੈਂ ਹੋਸਪਿਟਲ ਮੈਂ ਜਾ ਪਾਉਂਦੀ ਹਾਂ ਦਵਾਈ ਦਾਵੁਈ ਵਗੈਰਾ ਲੈਣ ਵਾਸਤੇ ਅਤੇ ਮੈਂ ਸਰੀਰ ਮੇਰਾ ਦੁਖਦਾ ਦੁਖਦਾ ਹੈ ਬਹੁਤ ਜ਼ਿਆਦਾ ਅਤੇ ਇਸ ਕਰਕੇ ਮੈਂ ਹੋਸਪਿਟਲ ਇੱਕ ਵਾਰ ਚੈੱਕਅਪ ਆਪਣਾ ਕਰਵਾਉਣ ਜਾਂਦੀ ਹਾਂ ਮੇਰੇ ਦਰਦ ਵਗੈਰਾ ਹੁੰਦੀ ਆ ਲੱਕ 'ਚ ਡਿਸਕ ਦੀ ਪ੍ਰੋਬਲਮ ਆ ਮੈਨੂੰ ਬਹੁਤ ਜ਼ਿਆਦਾ ਦਰਦ ਵਗੈਰਾ ਹੁੰਦੀ ਹੈ ਮੇਰੇ